ਪਟਰੋਲ ਦੀਆਂ ਵੱਧਦੀਆਂ ਕੀਮਤਾਂ ਨੇ ਸਾਡੀ ਬਾ ਸਾਡੀ ਬਾਈਕਿੰਗ ਸਿਸਟਮ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਕਿਉਂਕਿ ਅੱਜ ਕੱਲ ਹਾਂ ਅੱਜ ਕੱਲ ਵਾਹਨ ਵਾਹਨ ਸਾਡੀ ਜ਼ਿੰਦਗੀ ਦਾ ਅਹਿਮ ਰੋਲ ਨੇ ਜਿੱਥੇ ਵੀ ਆਪਾਂ ਜਾਂਦੇ ਹਾਂ ਆਪਣੇ ਬਾਈਕ ਵਗੈਰਾ ਕਾਰ ਵਗੈਰਾ ਲੈ ਕੇ ਜਾਂਦੇ ਹਾਂ ਹਰ ਇੱਕ ਚੀਜ਼ ਪਟਰੋਲ 'ਤੇ ਚੱਲਣ ਵਾਲੀ ਹੈ ਇਸ ਲਈ ਜਿਹੜੀਆਂ ਪਟਰੋਲ ਦੀਆਂ ਵੱਧਦੀਆਂ ਵੱਧ ਰਹੀਆਂ ਕੀਮਤਾਂ ਨੇ ਉਹ ਆਮ ਇਨਸਾਨ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਰਹੀਆਂ ਨੇ ਇਸ ਤੋਂ ਇਲਾਵਾ ਪਟਰੋਲ ਪਟਰੋਲ ਵਾਹਨਾਂ ਵਿੱਚੋਂ ਨਿਕਲਦਾ ਹੈ ਉਹਨਾਂ ਦਾ ਧੂੰਆਂ ਨਿਕਲਦਾ ਹੈ ਇਹ ਵਾਤਾਵਰਨ ਨੂੰ ਬਹੁਤ ਜ਼ਿਆਦਾ ਪ੍ਰਦੂਸ਼ਣ ਕਰ ਰਿਹਾ ਹੈ ਵਾਤਾਵਰਨ ਵਿੱਚ ਹਵਾ ਪ੍ਰਦੂਸ਼ਣ ਹੋ ਰਿਹਾ ਹੈ ਇਸ ਦੇ ਨਾਲ ਹੀ ਸ਼ੋਰ ਪ੍ਰਦੂਸ਼ਣ ਹੋ ਰਿਹਾ ਹੈ ਆਪਾਂ ਨੂੰ ਘੱਟ ਤੋਂ ਘੱਟ ਪਟਰੋਲ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਵਾਤਾਵਰਨ ਸੁਰੱਖਿਅਤ ਰਹਿ ਸਕੇ ਅਤੇ ਇਸ ਦੀਆਂ ਕੀਮਤਾਂ ਨੂੰ ਵੀ ਥੋੜ੍ਹਾ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਜੋ ਹਰ ਇੱਕ ਹਰ ਇੱਕ ਆਮ ਤੋਂ ਆਮ ਇਨਸਾਨ ਵੀ ਇਸਦੀ ਵਰਤੋਂ ਕਰ ਸਕੇ ਅਤੇ ਆਪਣੇ ਵਾਤਾਵਰਨ ਨੂੰ ਬਚਾ ਸਕੇ ਇਸ ਲਈ ਇਸ ਲਈ ਹਰ ਇੱਕ ਚੀਜ਼ ਪਟਰੋਲ ਦੀ ਥਾਂ 'ਤੇ ਆਪਾਂ ਨੂੰ ਬੈਂਟਰੀ ਜਾਂ ਸੋਲਰ ਸਿਸਟਮ ਚ ਚਲਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਨੂੰ ਕੋਈ ਸਾਡੇ ਵਾਤਾਵਰਨ ਨੂੰ ਕੋਈ ਨਕਸਾਨ ਨਾ ਹੋਵੇ ਅਤੇ ਆਪਾਂ ਅਤੇ ਸਾਡੇ ਕੰਮ ਵਿੱਚ ਵੀ ਕੋਈ ਰੁਕਾਵਟ ਨਾ ਆਵੇ